ਹੈਲੋ ਸਰਪੰਚ ਸਾਹਿਬ ਬੋਲਦੇ ਜੀ ਹਾਂਜੀ ਅਤੇ ਸਰਪੰਚ ਸਾਹਿਬ ਜੀ ਆਪਣੇ ਪਿੰਡਾਂ ਦੇ ਕਈ ਕੰਮ ਪਏ ਹੈਗੇ ਆ ਉਹ ਕਰੋ ਹੁਣ ਤੁਸੀਂ ਹਾਂਜੀ ਵੇਖੋ ਜੀ ਆਪਣੀਆਂ ਹਾਂਜੀ ਨਾਲੀਆਂ ਦਾ ਕੰਮ ਪਿਆ ਹੈਗਾ ਅਤੇ ਸੜਕਾਂ 'ਚ ਟੋਏ ਹੋਏ ਪਏ ਹੈਗੇ ਉੱਥੇ ਹੁਣ ਬਾਰਿਸ਼ ਦਾ ਪਾਣੀ ਖੜ੍ਹੇਗਾ ਠੀਕ ਹੈ ਅਤੇ ਆਪਣੀ ਵਾਟਰ ਬਕਸ ਦਾ ਬਹੁਤ ਬੁਰਾ ਹਾਲ ਹੈ ਅਤੇ ਉਹ ਨਾਲੀਆਂ ਨਾਲੀਆਂ ਦਾ ਪਾਣੀ ਆਪਣੇ ਟੂਟੀਆਂ ਦੇ ਵਿੱਚ ਮਿਕਸ ਹੋ ਕੇ ਆ ਰਿਹਾ ਹੈ ਇਹਦਾ ਪ੍ਰੋਬਲਮ ਹੱਲ ਕਰੋ ਤੁਸੀਂ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਕਿਉਂਕਿ ਅੱਜ ਕੱਲ ਫਿਰ ਤੁਹਾਨੂੰ ਪਤਾ ਬਿਮਾਰੀਆਂ ਬਹੁਤ ਚਿੰਬੜਦੀਆਂ ਹੈਗੀਆਂ ਪੀਲੀਆ ਵਗੈਰਾ ਹੋਈ ਜਾਂਦਾ ਹੈਜ਼ਾ ਹੁੰਦਾ ਅਤੇ ਪਿੰਡ ਨੂੰ ਪਾਣੀ ਖਰਾਬ ਹੋਇਆ ਅਤੇ ਫਿਰ ਕੀ ਫਾਇਦਾ ਤੁਹਾਡਾ ਵੋਟਾਂ ਪਾਉਣ ਦਾ ਹੈ ਨਾ ਹਾਂਜੀ ਹਾਂ ਇਹ ਸਾਰੇ ਰਲ ਕੇ ਆਪਾਂ ਇਹ ਕੰਮ ਕਰਨੇ ਹੈ ਅਤੇ ਹਾਂਜੀ ਅਤੇ ਪਹਿਲ ਦੇ ਅਧਾਰ 'ਤੇ ਇਹ ਕੰਮ ਕਰਾਂਗੇ ਅਤੇ ਹਾਂਜੀ ਹਾਂਜੀ ਅਤੇ ਸਰਕਾਰੀ ਸਕੂਲ ਦੀਆਂ ਦੀਵਾਰਾਂ ਉੱਚੀਆਂ ਕਰਵਾਉਣੀਆਂ ਠੀਕ ਕਰਵਾਉਣੀਆਂ ਉੱਤੋਂ ਹਾਂਜੀ ਠੀਕ ਹਾਂਜੀ ਅਤੇ ਡਿਸਪੈਂਸਰੀ 'ਚ ਡੋਕਟਰ ਨਹੀਂ ਆਉਂਦੇ ਪ੍ਰੋਪਰ ਉਹਨਾਂ ਦਾ ਵੀ ਤੁਸੀਂ ਕਰੋ ਕੁਛ ਹਾਂਜੀ ਹਾਂਜੀ ਠੀਕ ਹੈ ਅਤੇ ਇਹ ਸਾਰਾ ਆਪਣਾ ਸੁਧਾਰ ਕਰੋ ਪਿੰਡ ਦਾ ਠੀਕ ਹੈ ਜੀ ਧੰਨਵਾਦ